ਹਾਂਜੀ ਮੈਂ ਬਠਿੰਡੇ ਦੀ ਰਹਿਣ ਵਾਲੀ ਹਾਂ ਬਠਿੰਡੇ ਵਿੱਚ ਇੱਕ ਮੇਨ ਬਜ਼ਾਰ ਹੈ ਜਿਸ ਦਾ ਨਾਮ ਹੈ ਧੋਬੀ ਬਜ਼ਾਰ ਧੋਬੀ ਬਜ਼ਾਰ ਵਿੱਚ ਸਾਨੂੰ ਹਰ ਇੱਕ ਤਰ੍ਹਾਂ ਦੀ ਜੋ ਚੀਜ਼ ਹੈ ਉਹ ਮਿਲ ਜਾਂਦੀ ਹੈ ਇਸ ਵਿੱਚ ਜ਼ਿਆਦਾਤਰ ਕੱਪੜੇ ਦੀਆਂ ਦੁਕਾਨਾਂ ਹਨ ਇੱਥੋਂ ਕੱਪੜਾ ਜੋ ਬਹੁਤ ਵਧੀਆ ਰੇਟ 'ਤੇ ਮਿਲ ਜਾਂਦਾ ਹੈ ਅਤੇ ਬਹੁਤ ਸੋਹਣਾ ਜੋ ਹੈ ਕੱਪੜਾ ਮਿਲਦਾ ਹੈ ਜੇ ਗੱਲ ਕਰੀਏ ਅਸੀਂ ਅਨਾਜ ਮੰਡੀ ਦੀ ਤਾਂ ਨਰੂਆਣਾ ਵਿੱਚ ਅਨਾਜ ਮੰਡੀ ਹੈ ਜਿਸ ਲਈ ਸਾਨੂੰ ਅਨਾਜ ਨੂੰ ਦੂਰ ਕਿਤੇ ਲੈ ਕੇ ਜਾਣ ਲਈ ਜ਼ਿਆਦਾ ਸਾਡਾ ਟਾਈਮ ਵੀ ਖਰਾਬ ਨਹੀਂ ਹੁੰਦਾ ਅਤੇ ਜ਼ਿਆਦਾ ਆਵਾਜਾਈ ਦਾ ਜੋ ਖਰਚਾ ਉਹ ਵੀ ਨਹੀਂ ਹੁੰਦਾ ਸਾਨੂੰ ਜੇ ਮੈਂ ਗੱਲ ਕਰਾਂ ਬਠਿੰਡੇ ਵਿੱਚ ਸਬਜ਼ੀ ਮੰਡੀ ਦੀ ਤਾਂ ਉਹ ਵੀ ਜੋ ਹੈ ਸਬਜ਼ੀਆਂ ਬਹੁਤ ਘੱਟ ਰੇਟ 'ਤੇ ਮਿਲ ਜਾਂਦੀਆਂ ਹਨ ਇੱਥੋਂ ਹਰ ਕੋਈ ਜੋ ਹੈ ਸਬਜ਼ੀਆਂ ਖਰੀਦ ਸਕਦਾ ਹੈ ਧੋਬੀ ਮਾਰਕੀਟ ਵਿੱਚ ਜੋ ਕੱਪੜਿਆਂ ਦੀਆਂ ਦੁਕਾਨਾਂ ਹਨ ਉਹਨਾਂ ਦੇ ਕੁਛ ਦੁਕਾਨਾਂ ਦੇ ਜੋ ਰੇਟ ਹੈ ਉਹ ਬਹੁਤ ਜ਼ਿਆਦਾ ਹਨ ਜਿਨ੍ਹਾਂ ਕਰਕੇ ਕੁਛ ਲੋਕ ਹੈ ਜੋ ਕੱਪੜੇ ਨਹੀਂ ਖਰੀਦ ਸਕਦੇ ਜੇ ਆਪਾਂ ਗੱਲ ਕਰੀਏ ਸਬਜ਼ੀ ਮੰਡੀ ਦੀ ਤਾਂ ਸਬਜ਼ੀ ਵਿ ਦੀਆਂ ਜੋ ਵੈ ਉਂਝ ਦੁਕਾਨਾਂ ਲੱਗਦੀਆਂ ਹਨ ਉਨ੍ਹਾਂ 'ਤੇ ਸਬਜ਼ੀਆਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਹਨ ਜਿਹਨਾਂ ਕਰਕੇ ਜੋ ਹਰ ਕੋਈ ਆ ਸਬਜ਼ੀ ਨਹੀਂ ਖਰੀਦ ਸਕਦਾ ਇਸ ਲਈ ਜੇ ਲੋਕ ਜ਼ਿਆਦਾਤਰ ਮੰਡੀ ਤੋਂ ਸਬਜ਼ੀਆਂ ਖਰੀਦਦੇ ਹਨ ਜਿਸ ਦਿਨ ਸਪੈਸ਼ਲੀ ਜੋ ਮੰਡੀ ਦੀ ਸਬਜ਼ੀ ਦੀ ਲੱਗਦੀ ਹੈ ਤਾਂ ਉਸ ਵਿੱਚ ਜੋ ਸਬਜ਼ੀਆਂ ਦੇ ਰੇਟ ਬਹੁਤ ਘੱਟ ਹੁੰਦੇ ਹਨ ਅਤੇ ਲੋਕ ਆਸਾਨੀ ਨਾਲ ਸਬਜ਼ੀਆਂ ਲੈ ਸਕਦੇ ਹਨ